ਹੈਲੋ ਹਾਂਜੀ ਵੀਰ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਆ ਤੁਹਾਡੀ ਕੈਬ ਆਪਾਂ ਬੁੱਕ ਕਰੀ ਸੀ ਨਾ ਚਾਰ ਹਜ਼ਾਰ ਰੁਪਈਏ 'ਚ ਅੰਮ੍ਰਿਤਸਰ ਦੀ ਅਤੇ ਆਪਾਂ ਖੰਨੇ ਤੋਂ ਅੰਮ੍ਰਿਤਸਰ ਦੀ ਬੁੱਕ ਕਰੀ ਸੀ ਨਾ ਚਾਰ ਹਜ਼ਾਰ ਰੁਪਈਏ 'ਚ ਅਤੇ ਆਪਣੀ ਗੱਲ ਹੋਈ ਸੀ ਹੈ ਨਾ ਆਪਾਂ ਪੇਮੈਂਟ ਜਿਹੜੀ ਆ ਬਈ ਕਿ ਕੈਸ਼ ਦੇਵਾਂਗੇ ਸਾਰੀ ਹੈ ਨਾ ਅਤੇ ਮੈਂ ਉਹੀ ਗੱਲ ਕਰਨੀ ਸੀ ਅਤੇ ਮੇਰੇ ਕੋਲ ਕੈਸ਼ ਆ ਜਿਹੜਾ ਨਾ ਉਹ ਘੱਟ ਗਿਆ ਥੋੜ੍ਹਾ ਜਿਹਾ ਮੇਰੇ ਕੋਲ ਤਿੰਨ ਹਜ਼ਾਰ ਰੁਪਈਏ ਹੀ ਆ ਕੈਸ਼ ਮੈਂ ਇੱਦਾਂ ਕਹਿੰਦਾ ਸੀ ਕਿ ਹੈ ਤੁਹਾਨੂੰ ਹਜ਼ਾਰ ਰੁਪਈਆ ਕ ਔਨਲਾਈਨ ਕਰ ਦਿੰਦਾ ਨਾ ਪੇਮੈਂਟ ਜੇ ਤੁਹਾਨੂੰ ਠੀਕ ਲੱਗਦਾ ਹੈ ਨਾ ਅਤੇ ਕੈਸ਼ ਮੇਰੇ ਕੋਲ ਥੋੜ੍ਹਾ ਜਿਹਾ ਘੱਟ ਰਿਹਾ ਜੇ ਤੁਸੀਂ ਔਨਲਾਈਨ ਕਰਵਾ ਸਕਦੇ ਹੋ ਤਾਂ ਮੈਂ ਤੁਹਾਨੂੰ ਤਿੰਨ ਹਜ਼ਾਰ ਰੁਪਈਆ ਕੈ ਕੈਸ਼ ਦੇ ਦਿੰਦਾ ਅਤੇ ਹਜ਼ਾਰ ਰੁਪਈਆ ਤੁਹਾਨੂੰ ਮੈਂ ਔਨਲਾਈਨ ਕਰ ਦਿੰਦਾ ਜੇ ਦੇਖ ਲਓ ਤੁਸੀਂ ਲੈ ਸਕਦੇ ਹੋ ਕਰਵਾ ਸਕਦੇ ਹੋ ਤਾਂ ਔਨਲਾਈਨ ਕਰਵਾ ਲਓ ਹਜ਼ਾਰ ਰੁਪਈਆ ਅਤੇ ਜੇ ਨਹੀਂ ਵੀ ਕਰਵਾ ਸਕਦੇ ਫਿਰ ਆਪਾਂ ਇੱਦਾਂ ਕਰਦੇ ਹਾਂ ਕਿਤੇ ਨੇੜੇ ਏ ਟੀ ਐਮ ਦੇਖ ਲੈਂਦੇ ਹਾਂ ਕੋਈ ਨਾ ਕੋਈ ਉਹਦੇ 'ਚੋਂ ਮੈਂ ਤੁਹਾਨੂੰ ਕੱਢਵਾ ਕੇ ਹਜ਼ਾਰ ਰੁਪਈਆ ਅਤੇ ਕੈਸ਼ ਹੀ ਦੇ ਦਿੰਦਾ ਫੇਰ ਸਾਰੀ ਪੇਮੈਂਟ ਦੇਖ ਲਓ ਤੁਹਾਨੂੰ ਜਿੱਦਾਂ ਸਹੀ ਲੱਗਦਾ ਜੇ ਹਜ਼ਾਰ ਰੁਪਈਆ ਲੈ ਸਕਦੇ ਹੋ ਇੱਦਾਂ ਔਨਲਾਈਨ ਤਾਂ ਤਾਂ ਔਨਲਾਈਨ ਲੈ ਲਓ ਤਿੰਨ ਹਜ਼ਾਰ ਰੁਪਈਆ ਕੈਸ਼ ਲੈ ਲਓ ਨਹੀਂ ਬਾਕੀ ਸਾਰੇ ਫਿਰ ਕੈਸ਼ ਹੀ ਦੇ ਦੇਵਾਂ ਤੁਹਾਨੂੰ ਕੱਢਵਾ ਕੇ ਏ ਟੀ ਐਮ ਦੇਖ ਲੈਂਦੇ ਨੇੜੇ ਤੇੜੇ ਕੋਈ ਠੀਕ ਹੈ ਜੀ